ਖੇਤਾਂ ਵਿੱਚ ਵਰਤਦੇ ਹਨ ਇਸ ਦੇ ਨਾਲ ਖੇਤ ਹਰੇ ਭਰੇ ਰਹਿੰਦੇ ਹਨ ਪੁਰਾਣੇ ਪੁਰਾਣੇ ਜ਼ਮਾਨੇ ਵਿੱਚ ਲੋਕ ਆਪਣੇ ਵਿਹੜੇ ਨੂੰ ਲਿੱਪਦੇ ਸਨ ਅਤੇ ਗੋਹੇ 'ਤੇ ਹੀ ਪਾਥੀਆਂ ਦੇ ਬਣਾ ਕੇ ਰੋਟੀਆਂ ਬਣਾਉਂਦੇ ਸਨ ਘਰ ਵਿੱਚ ਸਜਾਵਟੀ ਫੁੱਲਾਂ ਬੂਟੀਆਂ ਵਿੱਚ ਹੀ ਗੋਹਾ ਪੈਂਦਾ ਹੈ ਜਿਸ ਨਾਲ ਫੁੱਲ ਬੂਟੇ ਨੂੰ ਬਹੁਤ ਲੱਗਦੇ ਹਨ ਘਰ ਦੀ ਸ਼ੁੱਧੀ ਵਾਸਤੇ ਪਾਥੀਆਂ ਉੱਤੇ ਗੂਗਲ ਦਾ ਧੂੰਆਂ ਪੂਰੇ ਘਰ ਵਿੱਚ ਘੁੰਮਾਇਆ ਜਾਂਦਾ ਹੈ ਗੋਹੇ ਦੇ ਧੂੰਏ ਨਾਲ ਮੱਛਰ ਵੀ ਖਤਮ ਹੋ ਜਾਂਦੇ ਹਨ ਵਾਤਾਵਰਨ ਵਿੱਚ ਸ਼ੁੱਧ ਹੋ ਜਾਂਦਾ ਇਸ ਤੋਂ ਪਤਾ ਚਲਦਾ ਹੈ ਕਿ ਗੋਹੇ ਦੀ ਵਰਤੋਂ ਕੀਤੀ ਜਾਂਦੀ ਹੈ